ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਹਰਪ੍ਰੀਤ ਟੂਰ ਟਰੈਵਲ ਤੋਂ ਬੋਲਦੇ ਭਾਈ ਭਾਅ ਜੀ ਅਮਨ ਨੇ ਨੰਬਰ ਦਿੱਤਾ ਸੀ ਤੁਹਾਡਾ ਅਤੇ ਅਮਨ ਨੇ ਮੈਨੂੰ ਨੰਬਰ ਦਿਤਾ ਸੀ ਕਹਿੰਦਾ ਵੀ ਮੈਂ ਕਿਹਾ ਮੂਹਰੇ ਹੋਲਾ ਮਹੱਲਾ ਆ ਰਿਹਾ ਅਤੇ ਆਪਾਂ ਮੈ ਕਿਹਾ ਉੱਥੇ ਜਾਣਾ ਆਨੰਦਪੁਰ ਸਾਹਿਬ ਜਾਣਾ ਟਰੈ ਗੱਡੀ ਕਰਾ ਕੇ ਦਿੱਲੀ ਤੋਂ ਆਪਾ ਜਾਣਾ ਆ ਦਿੱਲੀ ਤੋਂ ਮੈਂ ਬੋਲਦਾ ਅਤੇ ਪਿਛਲੇ ਸਾਲ ਮੁੰਡਾ ਇੱਕ ਆਪਣੇ ਦਿੱਲੀ ਤੋਂ ਗਿਆ ਸੀ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਉੱਥੇ ਹਰਪ੍ਰੀਤ ਟੂਰ ਟਰੈਵਲ ਜਿਹੜਾ ਕਹਿੰਦਾ ਬੜਾ ਜੈਨਿਉਨ ਰੇਟ ਹੈ ਕਹਿੰਦਾ ਉਹਨਾਂ ਦਾ ਅਤੇ ਆਪਣੇ ਉੱਥੇ ਜਾਣਾ ਆਪਾਂ ਆਨੰਦਪੁਰ ਸਾਹਿਬ ਅਤੇ ਸਾਨੂੰ ਇਤਿਹਾਸ ਦੱਸੋ ਮੈਨੂੰ ਉਹਦਾ ਕੀ ਇਤਿਹਾਸ ਆ ਅੱਛਾ ਅੱਛਾ ਜੀ

ਅੱਛਾ ਜੀ ਹਾਂਜੀ ਕਹਿੰਦੇ ਨਿਹੰਗ ਅਲੱਗ ਅਲੱਗ ਕਰਤੱਵ ਦਿਖਾਉਂਦੇ ਆ ਉਹ ਦੇਖਣਾ ਚਾਹੁੰਦੇ ਆਪਾਂ ਅਲੱਗ ਅਲੱਗ ਕਰਤੱਵ ਕਿੱਦਾਂ ਤੰਬੂ ਕਹਿੰਦੇ ਜੀ ਲੈ ਤੰਬੂ ਗੱਡ ਦੇ ਆ ਜੀ ਘੋੜਸਵਾਰੀ ਕਰਦੇ ਆ ਹਾਂਜੀ ਹਾਂਜੀ ਤਾਂ ਹੀ ਮੈਂ ਕਿਹਾ ਆਪਾਂ ਦੇਖ ਕੇ ਆਉਣਾ ਹੈ ਹੋਲਾ ਇਹ ਦੇਖਣ ਜਾਣਾ ਹੈ ਹੋਲਾ ਮੁਹੱਲਾ ਹਾਂ ਹਾਂਜੀ ਹਾਂਜੀ ਇਹੀ ਹੈ ਉਹੀ ਤਾਂ ਗੱਲ ਆ ਜਦੋਂ ਉਹਨੇ ਬਾਬੇ ਗੁਰੂ ਗੋਬਿੰਦ ਸਿੰਘ ਨੇ ਦਿਖਾਉਣਾ ਮੇਲਾ ਕਿਹਨੇ ਕਿਹਨੂੰ ਦਿਖਾਉਣਾ ਆ ਠੀਕ ਨਹੀਂ ਹਾਂਜੀ ਹਾਂਜੀ ਇਹ ਤਾਂ ਕਹਿੰਦੇ ਬਹੁਤ ਹੀ ਮੇਲੇ ਦੂਜੇ ਲੱਗਦੇ ਆ ਰੌਣਕ ਮੇਲਾ ਬਹੁਤ ਹੁੰਦਾ ਆ ਨਿਹੰਗ ਸਿੰਘ ਆਉਂਦੇ ਆ ਬਸ ਦੋ ਕੁ ਦਿਨ ਪਹਿਲਾਂ ਆ ਜਾਇਓ ਤੁਸੀਂ ਬਸ ਦੋ ਦਿਨ ਪਹਿਲਾਂ ਤੁਹਾਨੂੰ ਫੋਨ ਕਰਦਾਂਗੇ ਤੁਸੀਂ ਇੱਥੋਂ ਸਾਨੂੰ ਲੈ ਜਾਇਓ ਦੁਆਰਾ ਉੱਥੇ ਛੱਡ ਜਾਇਓ ਦੋ ਤਿੰਨ ਜਗ੍ਹਾ ਘੁੰਮਾ ਕੇ ਠੀਕ ਹੈ ਹੋਲਾ ਮਹੱਲਾ ਦਿਖਾ ਕੇ ਅਤੇ ਸਾਨੂੰ ਉੱਥੇ ਦੁਬਾਰਾ ਦਿੱਲੀ ਛੱਡ ਦਿਓ ਠੀਕ ਆ ਭਾਈ ਹਾਂਜੀ ਨਹੀਂ ਨਹੀਂ ਬਸ ਆਹੀ ਗੁ ਗੁਰੂਆਂ ਦਾ ਹੀ ਦੇਖਣਾ ਆਪਾਂ ਹਾਂਜੀ ਠੀਕ ਹੈ ਭਾਅ ਜੀ ਠੀਕ